ਪੁਰਾਣੇ ਸਮੇਂ ਦੇ ਵਿੱਚ ਮੋਹਾਲੀ ਵੀ ਰੋਪੜ ਜ਼ਿਲ੍ਹੇ ਦਾ ਹੀ ਇੱਕ ਹਿੱਸਾ ਸੀ ਪਰ ਜਦੋਂ ਆਬਾਦੀ ਦਾ ਵਿਕਾਸ ਹੋਇਆ ਤਾਂ ਸਰਕਾਰਾਂ ਨੇ ਮੱਦੇ ਨਜ਼ਰ ਰੱਖਦੇ ਹੋਏ ਮੋਹਾਲੀ ਨੂੰ ਇੱਕ ਨਵਾਂ ਜ਼ਿਲ੍ਹਾ ਘੋਸ਼ਿਤ ਕਰ ਦਿੱਤਾ ਮੋਹਾਲੀ ਜ਼ਿਲ੍ਹਾ ਚੰਡੀਗੜ੍ਹ ਸ਼ਹਿਰ ਦੇ ਨੇੜੇ ਪੈਂਦਾ ਹੈ ਇਸ ਕਰਕੇ ਇਹਦਾ ਵਿਕਾਸ ਵੀ ਬੜੀ ਤੇਜ਼ੀ ਨਾਲ ਹੋਇਆ ਅੱਜ ਕੱਲ੍ਹ ਦੇ ਸਮੇਂ ਵਿੱਚ ਇਹ ਇੱਕ ਤਰ੍ਹਾਂ ਨਾਲ ਇਲੈਕਟ੍ਰੀਓਨਿਕ ਯੁੱਗ ਦੇ ਯੁੱਗ ਨਾਲ਼ ਮਿਲਦਾ ਜੁਲਦਾ ਮੇਲ ਕਰਦਾ ਹੋਇਆ ਵਿਕਸਿਤ ਹੋ ਰਿਹਾ ਹੈ ਇਸਦੇ ਆਧੁਨਿਕ ਵਿਕਾਸ ਵੀ ਬੜੀ ਤੇਜ਼ੀ ਨਾਲ ਅੱਗੇ ਅੱਗੇ ਵੱਧ ਰਿਹਾ ਹੈ ਦੇਖਿਆ ਜਾਵੇ ਤਾਂ ਮੋਹਾਲੀ ਵਿੱਚ ਬਹੁਤ ਸਾਰੀਆਂ ਇਤਿਹਾਸਿਕ ਸਥਾਨ ਪਾਏ ਜਾਂਦੇ ਹਨ ਜਿਵੇਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਇਹਦਾ ਇਤਿਹਾਸ ਬਾਬਾ ਸ਼ਹੀਦ ਬਾਬਾ ਹਨੂੰਮਾਨ ਜੀ ਹਨੂੰਮਾਨ ਸਿੰਘ ਜੀ ਦੇ ਨਾਲ ਹੈ ਅਤੇ ਉਸ ਤੋਂ ਬਾਅਦ ਦੂਜੀ ਇਸਦੀ ਪ੍ਰਸਿੱਧ ਇਤਿਹਾਸਿਕ ਸਥਾਨ ਸਿਸਵਾਂ ਡੈਮ ਹੈ ਇੱਥੇ ਇੱਥੇ ਵੀ ਲੋਕ ਬਹੁ ਬਹ ਬਹੁਤ ਸਾਰੇ ਲੋਕ ਬਾਹਰ ਤੋਂ ਘੁੰਮਣ ਆਉਂਦੇ ਹਨ ਅਤੇ ਮੋਹਾਲੀ ਦੇ ਨੇੜੇ ਹੀ ਸ਼ਹਿਰ ਚੰਡੀਗੜ੍ਹ ਦੇ ਵਿੱਚ ਵੀ ਸੁਖਨਾ ਲੇਕ ਹੈ ਜਿੱਥੇ ਵੀ ਇੱਥੇ ਵੀ ਲੋਕ ਬਾਹਰ ਤੋਂ ਘੁੰਮਣ ਆਉਂਦੇ ਹਨ ਅਤੇ ਅਤੇ ਲੇਕ ਵਿੱਚ ਕਿਸ਼ਤੀਆਂ ਚਲਾਉਂਦੇ ਹਨ ਇਵੇਂ ਹੀ ਇਹ ਇਸ ਸਥਾਨ ਮੋਹਾਲੀ ਜ਼ਿਲ੍ਹਾ ਇਹਦਾ ਆਪਣੇ ਆਪ ਵਿੱਚ ਹੀ ਬਹੁਤ ਵਧੀਆ ਇੱਕ ਯੁੱਗ ਹੈ ਅਤੇ ਇਹ ਅੱਗੇ ਅੱਗੇ ਵਿਕਾਸ ਇਹਦਾ ਵੱਧਦਾ ਜਾ ਰਿਹਾ ਹੈ